ਹੈਲੋ ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਆ ਗਏ ਆ ਹਾਂਜੀ ਹਾਂਜੀ ਵੀ ਹੁਣ ਤੁਸੀਂ ਜਿਵੇਂ ਇੱਥੇ ਨਵੇਂ ਆਏ ਹੋ ਤਾਂ ਜਿਵੇਂ ਤੁਹਾਨੂੰ ਫਰੈਸ਼ ਸਬਜ਼ੀਆਂ ਲੈਣੀਆਂ ਹੈਗੀਆਂ ਤਾਂ ਤੁਸੀਂ ਜਿਵੇਂ ਸੁਬਾਹ ਸੁਬਾਹ ਜਿਵੇਂ ਇੱਥੇ ਆਪਣੇ ਗਲੀ ਵਗੈਰਾ ਦੇ ਵਿੱਚ ਕੋਈ ਸਬਜ਼ੀ ਵਗੈਰਾ ਦੇਣ ਆਉਂਦਾ ਹੈਗਾ ਠੀਕ ਹੈ ਉਹ ਆਪਾਂ ਨੂੰ ਨਾਲੇ ਤਾਂ ਮਹਿੰਗੀ ਸਬਜ਼ੀ ਲਗਾ ਦਿੰਦਾ ਹੈਗਾ ਅਤੇ ਨਾਲੇ ਸਬਜ਼ੀ ਇੱਕ ਆਉਂਦੀ ਹੈਗੀ ਆ ਅਤੇ ਕਈ ਵਾਰੀ ਉਹ ਫਰੈਸ਼ ਵੀ ਨਹੀਂ ਹੁੰਦੀ ਗੀ ਅਤੇ ਅਸੀਂ ਫਰੈਸ਼ ਸਬਜ਼ੀ ਲੈਣੀ ਹੈ ਤਾਂ ਤੁਸੀਂ ਆਪਣੇ ਇੱਥੇ ਜਿਹੜੇ ਮੰਡੀਆਂ ਵਗੈਰਾ ਹੈਗੇ ਆ ਰੈਡ ਕਰੋਸ ਕੋਲ ਮੰਡੀ ਲੱਗਦੀ ਆ ਠੀਕ ਹੈ ਘਾਹ ਮੰਡੀ ਹੈਗੀ ਆ ਪੁਰਾਣੀ ਮੰਡੀ ਆ ਉਥੋਂ ਲੋਕ ਹੈਗੇ ਆ ਉਹ ਸੁਬਹਾ ਸੁਬਹਾ ਆਪਣੇ ਖੇਤਾਂ 'ਚੋਂ ਪੱਟ ਕੇ ਨਾ ਸਬਜ਼ੀਆਂ ਉੱਥੇ ਦਿੰਦੇ ਆ ਅਤੇ ਉੱਥੇ ਸਬਜ਼ੀਆਂ ਬਹੁਤ ਹੀ ਜ਼ਿਆਦਾ ਫਰੈਸ਼ ਹੁੰਦੀਆਂ ਹੈਗੀਆਂ ਵੀ ਆਪਾਂ ਉਥੋਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਹਰੇਕ ਤਰ੍ਹਾਂ ਦੀ ਸਬਜ਼ੀ ਉੱਥੇ ਆਪਾਂ ਨੂੰ ਅਵੇਲੇਬਲ ਮਿਲ ਜਾਏਗੀ ਅਗਰ ਅਗਰ ਜਿਵੇਂ ਗਲੀ ਦੇ ਵਿੱਚ ਆ ਆਪਾਂ ਸੌ ਰੁਪਏ ਦੀ ਸਬਜ਼ੀ ਲੈਂਦੇ ਹਾਂ ਇੱਕ ਹੀ ਸਬਜ਼ੀ ਆਉਂਦੇ ਆ ਉੱਥੇ ਕੀ ਏ ਨਾਲੇ ਤਾਂ ਸਬਜ਼ੀਆਂ ਸੁਬਹਾ ਸੁਬਹਾ ਸਸਤੀਆਂ ਵੀ ਹੁੰਦੀਆਂ ਜਾਂ ਤਾਂ ਆਪਾਂ ਸੌ ਰੁਪਏ ਦੇ ਵਿੱਚ ਕੀ ਆ ਚਾਰ ਪੰਜ ਸਬਜ਼ੀਆਂ ਵੀ ਖਰੀਦ ਸਕਦੇ ਹੁੰਦੇ ਹੈਗੇ ਕਿਉਂਕਿ ਰੇਟ ਉੱਥੇ ਸੁਬਹਾ ਸੁਬਹਾ ਹੈਗਾ ਜਿਹੜਾ ਉਹ ਬਹੁਤ ਹੀ ਵਧੀਆ ਰੇਟ 'ਤੇ ਵਾਜਿਬ ਰੇਟ 'ਤੇ ਮਤਲਬ ਸਬਜ਼ੀਆਂ ਮਿਲ ਜਾਂਦੀਆਂ ਆਪਾਂ ਨੂੰ ਵੀ ਇੱਥੇ ਵੀ ਹਾਂਜੀ ਵੀ ਜਿਵੇਂ ਇਥੇ ਆਪਾਂ ਨੂੰ ਜਿਵੇਂ ਸੇਬ ਹੋ ਗਏ ਸੌ ਰੁਪਏ ਦੇ ਪਾਈਆ ਲੱਗ ਜਾਂਦਾ ਉੱਥੇ ਆਪਾਂ ਨੂੰ ਸੌ ਰੁਪਏ ਦੇ ਅੱਧਾ ਕਿਲੋ ਮਿਲ ਜਾਂਦੇ ਆ ਸੌ ਰੁਪਏ ਕਿਲੋ ਜਾਂ ਅੱਧਾ ਕਿੱਲੋ ਅਤੇ ਇਹ ਸਸਟੀਮ ਹੈ ਫਿਰ ਅਗਰ ਆਪਾਂ ਨੂੰ ਇੱਥੋਂ ਵੀ ਨਹੀਂ ਸੈਟ ਆਉਂਦੀ ਤਾਂ ਆਪਾਂ ਰੈਡ ਕਰੋਸ ਕੋਲ ਜਾ ਸਕਦੇ ਹੈਗੇ ਫਰੂਟਸ ਵਗੈਰਾ ਲੈਂਦੇ ਆ ਉੱਥੇ ਵੀ ਸ਼ਾਮ ਦੇ ਟਾਈਮ ਵਿੱਚ ਵੀ ਸੁਬਹਾ ਦੇ ਟਾਈਮ ਹੈਗਾ ਗਾ ਸਬਜ਼ੀਆਂ ਵਗੈਰਾ ਹੈਗੀਆਂ ਗੀਆਂ ਉਹ ਸਸਤੇ ਰੇਟ 'ਤੇ ਮਿਲ ਜਾਂਦੀਆਂ ਹੈਗੀਆਂ ਸ਼ਾਮ ਦੇ ਟਾਈਮ ਵੀ ਅਗਰ ਆਪਾਂ ਜਾਵਾਂਗੇ ਤਾਂ ਆਪਾਂ ਨੂੰ ਸਬਜ਼ੀਆਂ ਹੈਗੀਆਂ ਵਧੀਆ ਰੇਟ 'ਤੇ ਮਿਲ ਜਾਂਦੀ ਹੈਗੀਆਂ ਵੀ ਸਸਤੇ ਰੇਟ 'ਤੇ ਵੀ ਆਪਾਂ ਕਿੱਥੇ ਲੈਂਦੇ ਸਬਜ਼ੀਆਂ ਦੋ ਦੋ ਆ ਉੱਥੇ ਆਪਾਂ ਚਾਰ ਚਾਰ ਸਬਜ਼ੀਆਂ ਲੈ ਕੇ ਆ ਸਕਦੇ ਹਾਂ ਹਾਂਜੀ ਕਿਉਂਕਿ ਸ਼ਾਮ ਨੂੰ ਸਾਰੇ ਹੁੰਦੇ ਹੈਗੇ ਵੀ ਫਟਾਫਟ ਆਪਦੇ ਸਬਜ਼ੀਆਂ ਵੇਚ ਕੇ ਵੀ ਆਪਾਂ ਆਪਦੇ ਘਰ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰੀਏ ਤਾਂ ਕਰਕੇ ਵੀ ਕਈ ਹੁੰਦੇ ਹੈਗੇ ਸ਼ਾਮ ਨੂੰ ਕੀ ਸਬਜ਼ੀਆਂ ਦਾ ਰੇਟ ਆ ਉਹ ਘਟਾ ਦਿੰਦੇ ਆ ਵੀ ਜਲਦੀ ਜਲਦੀ ਸਾਡੇ ਸਬਜ਼ੀਆਂ ਵਿਕਣ ਵੀ ਅਸੀਂ ਵੀ ਘਰ ਦਿਆਂ ਦੇ ਟਾਈਮ ਸਪੈਂਡ ਕਰੀਏ ਤਾਂ ਕਰਕੇ ਫਿਰ ਹਾਂਜੀ ਹਾਂਜੀ ਹਾਂਜੀ ਜ਼ਰੂਰ ਜਦੋਂ ਤੁਸੀਂ ਕਹੋਗੇ ਅਸੀਂ ਤੁਹਾਡੇ ਲਈ ਤੁਹਾਡੇ ਨਾਲ ਉਦੋਂ ਹੀ ਚਲਾਂਗੇ ਹਾਂਜੀ ਹਾਂਜੀ ਕੋਈ ਨਹੀਂ ਠੀਕ ਹੈ ਜੀ